ਪੰਜਾਬ ਦੀ ਸਿਆਸੀ ਪ੍ਰਣਾਲੀ ਦੇ ਵਿੱਚ ਪਹਿਲੇ ਦੇਖੋ ਇੱਕ ਮੁੱਖ ਮੰਤਰੀ ਹੁੰਦਾ ਹੈ ਮੁੱਖ ਮੰਤਰੀ ਦੇ ਨੀਚੇ ਫਿਰ ਕੈਬਨਿਟ ਮੰਤਰੀ ਹੁੰਦੇ ਹਨ ਅਤੇ ਜਿਹੜੀ ਸ਼ਹਿਰ ਦੀ ਇੱਕ ਨਗਰ ਪਾਲਿਕਾ ਦੀ ਸਰਕਾਰ ਹੁੰਦੀ ਹੈ ਉਸ ਦੇ ਵਿੱਚ ਇੱਕ ਨਗਰ ਕੌਂਸਲ ਦਾ ਪ੍ਰਧਾਨ ਹੁੰਦਾ ਹੈ ਅਤੇ ਉਸ ਦੇ ਨੀਚੇ ਫਿਰ ਮਿਉਂਸਿਪਲ ਕੌਂਸਲਰ ਹੁੰਦੇ ਹੈ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਇੱਕ ਪੰਚ ਸਰਪੰਚ ਹੁੰਦਾ ਹੈ ਅਤੇ ਸਰਪੰਚ ਦੇ ਹੇਠਾਂ ਫਿਰ ਪੰਚ ਕੰਮ ਕਰਦੇ ਹਨ